ਪਿੱਠ ਦੇ ਦਰਦ ਨੂੰ ਠੀਕ ਕਰਨ ਲਈ ਸਾਡੇ ਪਿੰਡ ਵਿੱਚ ਸਰ੍ਹੋਂ ਅਤੇ ਨਾਰੀਅਲ ਦੇ ਤੇਲ ਨਾਲ ਮਾਲਿਸ਼ ਕੀਤੀ ਜਾਂਦੀ ਹੈ ਕਾਲੀ ਮਿਰਚ ਦਾ ਸੇਵਨ ਕੀਤਾ ਜਾਂਦਾ ਹੈ ਸੁੰਡ ਅਤੇ ਸ਼ੱਕਰ ਨੂੰ ਦੇਸੀ ਘਿਓ ਵਿੱਚ ਭੁੰਨ ਕੇ ਉਸਦਾ ਵੀ ਸੇਵਨ ਕੀਤਾ ਜਾਂਦਾ ਹੈ ਕਿਸੇ ਨਰਮ ਕੱਪੜੇ ਨੂੰ ਅੱਗ ਜਾਂ ਭਾਫ਼ ਨਾਲ ਗਰਮ ਕਰਕੇ ਵਾਰ ਵਾਰ ਪਿੱਠ ਨੂੰ ਸੇਕ ਦਿੱਤਾ ਜਾਂਦਾ ਹੈ ਇਸ ਨਾਲ ਵੀ ਪਿੱਠ ਦੇ ਦਰਦ ਨੂੰ ਆਰਾਮ ਮਿਲਦਾ ਹੈ ਮਣਕਿਆਂ ਦੀ ਮਾਲਿਸ਼ ਕੀਤੀ ਜਾਂਦੀ ਹੈ ਬਜ਼ੁਰਗ ਔਰਤਾਂ ਦੁੱਧ ਨੂੰ ਗਰਮ ਕਰਕੇ ਉਸ ਵਿੱਚ ਹਲਦੀ ਘੋਲ ਕੇ ਵੀ ਪਿਲਾਉਂਦੀਆਂ ਹਨ ਇਸ ਨਾਲ ਵੀ ਪਿੱਠ ਦੇ ਦਰਦ ਨੂੰ ਆਰਾਮ ਮਿਲਦਾ ਹੈ